ਮੇਰਾ ਮਨਪਸੰਦ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਹੈ ਅਤੇ ਹਫ਼ਤੇ ਵਿੱਚ ਦੋ ਤਿੰਨ ਵਾਰੀ ਮੈਂ ਇਹੀ ਖਾਂਦਾ ਹਾਂ ਅਤੇ ਇਹ ਸ ਸਰ੍ਹੋਂ ਜਿਹੜੀ ਆ ਖੇਤਾਂ ਵਿੱਚ ਤੋੜ ਕੇ ਲਿਆਉਂਦੀ ਜਾਂਦੀ ਹੈ ਅਤੇ ਇਸ ਵਿੱਚ ਪਾਲਕ ਮੇਥੇ ਮੇਥੀ ਅਤੇ ਚਲਾਈ ਵਗੈਰਾ ਪਾ ਪਾ ਕੇ ਬਣਾਏ ਸਾਗ ਬਣਾਇਆ ਜਾਂਦਾ ਹੈ ਅਤੇ ਮੱਕੀ ਦੀ ਰੋਟੀ ਜਿਹੜੀ ਆ ਆਟਾ ਗੁੰਨਣਾ ਸੌਖਾ ਹੈ ਅਤੇ ਪਾਚਨ ਵੀ ਬਹੁਤ ਛੇਤੀ ਪ ਸਰੀਰ ਪਚਦੀ ਆ ਅਤੇ ਕਣਕ ਦੇ ਆਟੇ ਨਾਲੋ ਸ ਗੁੰਨਣਾ ਨਹੀਂ ਪੈਂਦਾ ਇਸ ਨੂੰ ਜ਼ਿਆਦਾ ਅਤੇ ਇਸ ਜੇਕਰ ਲੱਸੀ ਨਾਲ ਮਿਲ ਜੇ ਮੱਖਣ ਮਿਲ ਜੇ ਤਾਂ ਇਹਦਾ ਸੁਆਦ ਹੋਰ ਏ ਬਣ ਜਾਂਦਾ ਅਤੇ ਇਸ ਵਿੱਚ ਆਇਰਨ ਬਹੁਤ ਜ਼ਿਆਦਾ ਅਤੇ ਅਸੀਂ ਇਸ ਨੂੰ ਹਫ਼ਤੇ ਵਿੱਚ ਦੋ ਤਿੰਨ ਵਾਰੀ ਸਾ ਸਰਦੀਆਂ ਵਿੱਚ ਜ਼ਰੂਰੀ ਖਾਂਦੇ ਹਨ